ਸਤਿ ਸ਼੍ਰੀ ਅਕਾਲ ਜੀ ਮੈਂ ਜਿਹੜੇ ਤੁਹਾਡੇ ਤੋਂ ਬੱਚਿਆਂ ਦੇ ਕੱਪੜੇ ਔਡਰ ਕੀਤੇ ਸਨ ਉਹ ਕੱਪੜੇ ਜਿਹੜੇ ਹਨ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਸਾਈਜ਼ ਬਹੁਤ ਛੋਟੇ ਨਿਕਲੇ ਹਨ ਜਿਸ ਸਾਈਜ਼ ਦਾ ਮੈਂ ਤੁਹਾਨੂੰ ਕਿਹਾ ਸੀ ਉਹ ਕੱਪੜੇ ਨਹੀਂ ਆਏ ਹਨ ਛੋਟੇ ਸਾਈਜ਼ ਹਨ ਜਿਹੜੇ ਬੱਚਿਆ ਦੇ ਫਿੱਟ ਨਹੀਂ ਹੋਏ ਦੂਜੇ ਨੰਬਰ 'ਤੇ ਉਹਨਾਂ ਦੀ ਜਿਹੜੀ ਕੁਆਲਿਟੀ ਹੈ ਬਹੁਤ ਘਟੀਆ ਹੈ ਜਿਹੜੀ ਕਿ ਉਦੇ ਹੀ ਛਿੱਜ ਰਹੇ ਹਨ ਕੱਪੜੇ ਤੀਜੇ ਨੰਬਰ 'ਤੇ ਉਹਨਾਂ ਦੇ ਰੰਗ ਵੀ ਬਿਲਕੁਲ ਬੇਢੰਗੇ ਹਨ ਜਿਹੜੇ ਕਿ ਨਾ ਬੱਚਿਆਂ ਦੇ ਪਸੰਦ ਆਏ ਨਾ ਮੇਰੇ ਚੌਥੇ ਨੰਬਰ 'ਤੇ ਜਿਹੜੀ ਉਹਨਾਂ ਦੀ ਪੈਕਿੰਗਜ ਸੀ ਉਹ ਵੀ ਬਿਲਕੁਲ ਘਟੀਆ ਸੀ ਅਤੇ ਜਿਹੜਾ ਬੋਕਸ ਸੀ ਉਹ ਬਿਲਕੁਲ ਫਟਿਆ ਹੋਇਆ ਮੈਨੂੰ ਰਿਸੀਵ ਹੋਇਆ ਸੋ ਕਿਰਪਾ ਕਰਕੇ ਮੇਰੇ ਜਿਹੜੇ ਪੈਸੇ ਹਨ ਉਹ ਮੈਨੂੰ ਵਾਪਸ ਦੇ ਦਿੱਤੇ ਜਾਣ ਧੰਨਵਾਦ